ਮੈਂ ਜਾਣਨਾ ਚਾਹੁੰਦਾ ਜਾਂ ਚਾਹੁੰਦੀ ਹਾਂ ਕਿ ਮੇਰਾ ਈ ਪੀ ਐਫ ਓ ਐਪਲੀਕੇਸ਼ਨ ਦੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ ਇੱਥੇ ਮੈਂ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਿਵੇਂ ਕਰ ਸਕਦਾ ਹਾਂ ਈ ਪੀ ਐਫ ਓ ਪੋਰਟਲ 'ਤੇ ਜਾਓ ਦੂਜਾ ਸੇਵਾਵਾਂ ਵਿਕਲਪ 'ਤੇ ਕਲਿੱਕ ਕਰੋ ਤੀਜਾ ਐਡਵਾਂਸ ਸਰਵਿਸਸ ਵਿਕਲਪ 'ਤੇ ਕਲਿਕ ਕਰੋ ਚੌਥਾ ਲੋਗਿਨ 'ਤੇ ਕਲਿੱਕ ਕਰੋ ਅਤੇ ਆਪਣਾ ਯੂ ਏ ਐਨ ਦਰਜ ਕਰੋ ਨੰਬਰ ਅਤੇ ਪਾਸਵਰਡ ਦਰਜ ਕਰੋ ਅਡਵਾਂਸ ਸਟੇਟਸ ਵਿਕਲਪ 'ਤੇ ਕਲਿੱਕ ਕਰੋ ਆਪਣਾ ਯੂ ਏ ਐਨ ਦਰਜ ਕਰੋ ਨੰਬਰ ਅਤੇ ਹੋਰ ਐਪਲੀਕੇਸ਼ਨ ਰੈਫਰੰਸ ਨੰਬਰ ਦਾਖਲ ਕਰੋ ਸਥਿਤੀ ਵਿਥੋਂ 'ਤੇ ਕਲਿਕ ਕਰੋ ਹੁਣ ਤੁਸੀਂ ਆਪਣੀ ਐਦਵਾਂਸ ਐਪਲੀਕੇਸ਼ਨ ਦੀ ਸਥਿਤੀ ਦੇਖੋਗੇ